ਜੇਕਰ ਪੰਜਾਬ ਵਿੱਚ ਰਵਾਇਤੀ ਤਿਉਹਾਰਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਬਹੁਤ ਸਾਰੇ ਰਵਾਇਤੀ ਤਿਉਹਾਰ ਅਤੇ ਸਮਾਗਮ ਮਨਾਏ ਜਾਂਦੇ ਨੇ ਇਹਨਾਂ ਵਿੱਚੋਂ ਇੱਕ ਪ੍ਰਸਿੱਧ ਅਤੇ ਪੁਰਾਣਾ ਸਮਾਗਮ ਤਿਉਹਾਰ ਹੋਲਾ ਮਹੱਲਾ ਹੈ ਇਹ ਹੋਲਾ ਮਹੱਲਾ ਹਰ ਸਾਲ ਆਨੰਦਪੁਰ ਸਾਹਿਬ ਤਖਤ ਸ਼੍ਰੀ ਸ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਇਹ ਹੋਲਾ ਮਹੱਲਾ ਮਾਰਚ ਦੇ ਮਹੀਨੇ ਵਿੱਚ ਹੋਲੀ ਦੇ ਨੇੜੇ ਤੇੜੇ ਹੁੰਦਾ ਹੈ ਇਹਨੂੰ ਦੇਖਣ ਲਈ ਬਹੁਤ ਸਾਰੇ ਲੋਕ ਬਾਹਰ ਤੋਂ ਵੀ ਆਉਂਦੇ ਹਨ ਬਾਹਰਲੇ ਮੁਲਕਾਂ ਦੇ ਲੋਕ ਆਉਂਦੇ ਨੇ ਕਿਉਂਕਿ ਉੱਥੇ ਨਿਹੰਗ ਸਿੰਘ ਆਪਣੇ ਗੱਤਕਾ ਦੇ ਜੌਹਰ ਘੋੜ ਘੋੜ ਸਵਾਰੀ ਦੋ ਜੌਹਰ ਅਤੇ ਹੋਰ ਬਹੁਤ ਸਾਰੇ ਕਰਤੱਬ ਦਿਖਾਉਂਦੇ ਆ ਉਸ ਟਾਈਮ ਪੂਰੀ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦੀ ਖੁਸ਼ੀ ਵਿਚ ਉੱਥੇ ਤਿਉਹਾਰ ਮਨਾਉਂਦੀਆਂ ਇਹ ਤਿਉਹਾਰ ਹੋਲਾ ਮਹੱਲਾ ਹਰ ਸਾਲ ਬੜੇ ਜੋਸ਼ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਹੋਲੇ ਮਹੱਲੇ ਦੇ ਆਖਰੀ ਦਿਨ ਆਖਰੀ ਦਿਨ ਮਹੱਲਾ ਕੱਢਿਆ ਜਾਂਦਾ ਹੈ ਜਿਹੜਾ ਕਿ ਅਨੰਦਪੁਰ ਸਾਹਿਬ ਦੇ ਸਟੇਡੀਅਮ ਤੱਕ ਜਾਂਦਾ ਹੈ ਇਸ ਵਿੱਚ ਦੇਖਣ ਲਈ ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਬਹੁਤ ਬਹੁਤ ਦੂਰ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਏਰੀਏ ਦੇ ਜ਼ਿਆਦਾਤਰ ਸੰਗਤਾਂ ਆਉਂਦੀਆਂ ਏ ਇਸ ਹੋਲੇ ਮਹੱਲੇ ਨੂੰ ਦੇਖਣ ਲਈ ਹਰ ਸਾਲ ਸੰਗਤਾਂ ਵਿੱਚ ਉਤਸ਼ਾਹ ਪਾਇਆ ਜਾਂਦਾ ਹੈ